ਜਿਹੜੇ ਸਾਡੇ ਪੰਜਾਬ ਵਿੱਚ ਮਿਸਤਰੀਆਂ ਦੀ ਕਲਾ ਹੈ ਉਹ ਬਹੁਤ ਜ਼ਿਆਦੇ ਪ੍ਰਸਿੱਧ ਹੈ ਜਿਵੇਂ ਸਾਡੇ ਪੰਜਾਬ ਵਿੱਚ ਕਿਲ੍ਹੇ ਹੁੰਦੇ ਹਨ ਜਾਂ ਆਪਣੀ ਨਵੀਂ ਖੋਜ ਤਿਆਰ ਕਰਨ ਵਾਸਤੇ ਉਨ ਉਹ ਬਹੁਤ ਚੀਜ਼ਾਂ ਪੈਦਾ ਕਰਦੀਆਂ ਹਨ ਜਿਵੇਂ ਕਿਲ੍ਹੇ ਆਪਣੇ ਪੰਜਾਬ ਦੇ ਜਿੰਨੇ ਵੀ ਸੰਦ ਹੁੰਦੇ ਹਨ ਪੰਜਾਬ ਵਿੱਚ ਹੀ ਬਣਾਉਂਦੇ ਹਨ ਮੂਰਤੀਆਂ ਜਾਂ ਕਿਸੇ ਦੀ ਪੇਂਟਿੰਗ ਹੋਰ ਕਲਾ ਬਰਤਨ ਅਤੇ ਇਹ ਹੀ ਜਿਹੀਆਂ ਚੀਜ਼ਾ ਬਹੁਤ ਹਨ ਜੋ ਪੰਜਾਬ ਵਿੱਚ ਵੱਖਰੀ ਪਹਿਚਾਣ ਬਣ ਜਾਂਦੀ ਹੈ ਜਿਸ ਨਾਲ ਪੰਜਾਬ ਵਿੱਚ ਜਿੰਨੇ ਮਿਸਤਰੀ ਹਨ ਉਹ ਨਵੀਂ ਤੋਂ ਨਵੀਂ ਚੀਜ਼ ਕੱਢਦੇ ਹਨ ਜਿਸ ਨਾਲ ਸਮਾਜ ਵਿੱਚ ਉਹ ਜ਼ਿਆਦਾ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਇਸ ਲਈ ਪੰਜਾਬ ਵਿੱਚ ਜਿਵੇਂ ਜਿਵੇਂ ਆਪਣੇ ਟੂ ਸਾਪੇ ਸ ਸਾਪੇ ਬਣ ਜਾਂਦੇ ਹਨ ਅਤੇ ਜਿਹੜੀ ਵੀ ਪੰਜਾਬ ਦੀ ਖੇਤੀ ਹੈ ਉਹ ਆਪਣੇ ਆਪ ਦੇ ਹਿਸਾਬ ਦੇ ਨਾਲ ਜਿਮੀਂਦਾਰ ਪੈਦਾ ਕਰਦਾ ਹੈ ਇਸ ਲਈ ਪੰਜਾਬ ਵਿੱਚ ਬਹੁਤ ਜ਼ਿਆਦਾ ਐਸੀਆਂ ਖੋਜਾਂ ਹੁੰਦੀਆਂ ਨੇ ਜਿਸ ਨਾਲ ਆਨ ਨਵੀਂ ਪੀੜ੍ਹੀ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਧੰਨਵਾਦ